ਸਾਡੇ ਪਿੰਡ ਖੁਬਹੈੜੀ ਵਿੱਚ ਮੁੱਖ ਬਿਜ਼ਨਸ ਖੇਤੀਬਾੜੀ ਦਾ ਹੈ ਜ਼ਿਆਦਾਤਰ ਪਿੰਡ ਦੇ ਲੋਕ ਖੇਤੀਬਾੜੀ 'ਤੇ ਹੀ ਨਿਰਭਰ ਕਰਦੇ ਹਨ ਅਤੇ ਉਹਨਾਂ ਦਾ ਸਹਾਇਕ ਕਿੱਤਾ ਹੈ ਪਸ਼ੂ ਪਾਲਕ ਜਿਵੇਂ ਬੱਕਰੀ ਸੂਰ ਮੱਝਾਂ ਗਾਵਾਂ ਅਤੇ ਸਾਡੇ ਪਿੰਡ ਦੇ ਨਾਲੇ ਦੋ ਵੱਡੇ ਸ਼ਹਿਰ ਪੈਂਦੇ ਹਨ ਚੰਡੀਗੜ੍ਹ ਅਤੇ ਮੋਹਾਲੀ ਅਤੇ ਉਹਨਾਂ ਦਾ ਦੁੱਧ ਅਤੇ ਆਂਡੇ ਜਿਵੇਂ ਮੁਰਗੀਆਂ ਵੀ ਪਾਲਦੇ ਹਨ ਉਹ ਮੋਹਾਲੀ ਸ਼ਹਿਰ ਵਿਕਦੇ ਹਨ ਅਤੇ ਬੜਾ ਵੇਰਕਾ ਪਲਾਂਟ ਵੀ ਮੋਹਾਲੀ ਹੈ ਉਹ ਵੀ ਉਹਨੇ ਵੀ ਪਿੰਡ ਵਿੱਚ ਡੈਅਰੀ ਖੋਲ੍ਹੀ ਹੋਈ ਹੈ ਅਤੇ ਉੱਧਰ ਵੀ ਦੁੱਧ ਜਾਂਦਾ ਹੈ ਅਤੇ ਸਾਡੇ ਪਿੰਡ ਬਹੁਤ ਸਾਰੇ ਕਰਿਆਨਾ ਸਟੋਰ ਵੀ ਹਨ ਜਿਵੇਂ ਕਿ ਪੰਦਰਾਂ ਤੋਂ ਵੀਹ ਦੇ ਵਿੱਚ ਵਿੱਚ ਕਰਿਆਨਾ ਸਟੋਰ ਹੈ ਅਤੇ ਪਿੰਡ ਦੇ ਨਾਲ ਫੈਕਟਰੀ ਵੀ ਹੈ ਜਿਸ ਵਿੱਚ ਆਪਣੇ ਸ਼ਰਾਬ ਬਣਦੀ ਹੈ ਅਤੇ ਉੱਥੇ ਜਿਵੇਂ ਕਿ ਕਈ ਘਰਾਂ ਕੋਲ ਇੱਥੇ ਜ਼ਮੀਨਾਂ ਨਹੀਂ ਹਨ ਅਤੇ ਉਹ ਫੈਕਟਰੀ 'ਤੇ ਨਿਰਭਰ ਕਰਦੇ ਹਨ ਉਹਨਾਂ ਦਾ ਕਮਾਊ ਕਿੱਤਾ ਫੈਕਟਰੀ ਹੀ ਹੈ ਅਤੇ ਇੱਥੇ ਬਹੁਤ ਸਾਰੀਆਂ ਆਪਣੀਆਂ ਤਰਖਾਣਾਂ ਦੀਆਂ ਦੁਕਾਨਾਂ ਵੀ ਹੈ ਜਿਵੇਂ ਵੈੱਲਡਿੰਗ ਦੀ ਹੈ ਲੱਕੜੀ ਦੀ ਹੈ ਅਤੇ ਕਈਆਂ ਦੇ ਆਪਣੇ ਫਰਨੀਚਰ ਸਟੋਰ ਹੈ ਅਤੇ ਉਹਨਾਂ ਦਾ ਕਿੱਤਾ ਉਹਨਾਂ ਦੁਕਾਨਾਂ ਤੋਂ ਚੱਲਦਾ ਹੈ ਅਤੇ ਚੰਡੀ ਚੰਡੀ ਨਿਊ ਚੰਡੀਗੜ੍ਹ ਸਾਡੇ ਪਿੰਡ ਵੱਲ ਨੂੰ ਵੱਧ ਰਿਹਾ ਹੈ ਅਤੇ ਇੱਥੇ ਡੀਲਰਾਂ ਨੇ ਆਪਣੇ ਔਫਿਸ ਵੀ ਖੋਲ੍ਹੇ ਹਨ ਜਿਵੇਂ ਕਿ ਲੋਕ ਜ਼ਮੀਨਾਂ ਵੇਚ ਰਹੇ ਹਨ ਅਤੇ ਅੱਗੇ ਤੋਂ ਅੱਗੇ ਆਪਣਾ ਪੈਸਾ ਹੋਰ ਕੰਮਾਂ ਵਿੱਚ ਨਿਵੇਸ਼ ਕਰਦੇ ਹਨ ਅਤੇ ਆਪਣਾ ਕਾਰੋਬਾਰ ਵਧਾ ਰਹੇ ਹਨ ਅਤੇ ਇੱਥੇ ਨਵੀਆਂ ਮਸ਼ੀਨਰੀਆਂ ਵੀ ਲੋਕ ਲੈ ਕੇ ਆ ਰਹੇ ਹਨ ਤਾਂ ਕਿ ਜਿਹੜਾ ਉਹਨਾਂ ਦਾ ਕਾਰੋਬਾਰ ਹੈ ਉਹ ਹੋਰ ਵੱਧਦਾ ਜਾਵੇ ਅਤੇ ਨੌਜਵਾਨ ਹੈ ਉਹ ਬਾਹਰ ਨੂੰ ਵੀ ਜਾ ਰਹੇ ਹਨ ਸਾਡੇ ਪਿੰਡ ਤੋਂ ਤੋਂ ਜਿਵੇਂ ਘਰ ਵਿੱਚ ਦੋ ਕਿਸੇ ਦੇ ਪੁੱਤਰ ਜਾਂ ਧੀਆਂ ਪੁੱਤਰ ਹੈ ਤਾਂ ਉਹ ਇੱਕ ਨੂੰ ਬਾਹਰ ਭੇਜ ਰਹੇ ਹਨ ਅਤੇ ਉੱਥੋਂ ਵੀ ਉਹਨਾਂ ਦਾ ਇਨਕਮ ਸੋਰਸ ਚੱਲਦਾ ਹੈ ਅਤੇ ਇੱਥੇ ਆਪਣੇ ਸਾਡੇ ਪਿੰਡ ਵਿੱਚ ਫੀਡ ਸਟੋਰ ਵੀ ਹੈ ਦੋ ਫੀਡ ਸਟੋਰ ਹੈ ਉਹ ਮਤਲਬ ਲਾਗ ਦੇ ਏਰੀਏ ਨੂੰ ਉਹੀ ਫੀਡ ਸਪਲਾਈ ਕਰਦੇ ਹਨ ਅਤੇ ਉਹਨਾਂ ਦਾ ਕਾਰੋਬਾਰ ਵੀ ਬੜਾ ਤਕੜਾ ਹੈ